ਹੁਣ ਦੀ ਸਿੱਖਿਆ ਪ੍ਰਣਾਲੀ ਕਾਫ਼ੀ ਚੰਗੀ ਆ ਹੁਣ ਪੰਜਾਬ ਦੇ ਸਾਰੀ ਸਿ ਸਰਕਾਰੀ ਸਕੂਲਾਂ ਦੇ ਵਿੱਚ ਅੱਠਵੀਂ ਤੱਕ ਦੀ ਪੜ੍ਹਾਈ ਬਿਲਕੁਲ ਫਰੀ ਆ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਹੀ ਮਿਡ ਡੇ ਮੀਲ ਫਰੀ ਦੇ ਵਿੱਚ ਵਰਦੀਆਂ ਫਰੀ ਦੇ ਵਿੱਚ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਅਤੇ ਚੰਗੇ ਅਧਿਆਪਕ ਜਿਹੜੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਹੈਗੇ ਨੇ ਜੋ ਕਿ ਟੈਟ ਕਲੀਅਰ ਕਰਨ ਤੋਂ ਬਾਅਦ ਹੀ ਨਿਯੁਕਤ ਕੀਤੇ ਜਾਂਦੇ ਨੇਗੇ ਪਰ ਫਿਰ ਵੀ ਜਿਹੜੇ ਪੇਂਡੂ ਖੇਤਰ ਆ ਉਹਦੇ ਵਿੱਚ ਸਿੱਖਿਆ ਨਾਲ ਰਿਲੇਟਡ ਬੱਚੇ ਕਾਫ਼ੀ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਗਾ ਜਿਵੇਂ ਕਿ ਪਿੰਡਾਂ ਦੇ ਵਿੱਚ ਸਰਕਾਰੀ ਸਕੂਲਾਂ ਦੀ ਘਾਟ ਆ ਸਪੈਸ਼ਲੀ ਸਕੈਂਡਰੀ ਸਕੂਲ ਪਿੰਡਾਂ ਦੇ ਵਿੱਚ ਨਹੀਂ ਹੈਗੇ ਗੇ ਇਸ ਦੇ ਲਈ ਸਰਕਾਰ ਨੂੰ ਪਿੰਡਾਂ ਦੇ ਵਿੱਚ ਸੈਕੰਡਰੀ ਸਕੂਲ ਆ ਜਿਹੜੇ ਖੋਲ ਦਿੱਤੇ ਜਾਣੇ ਚਾਹੀਦੇ ਆ ਜਿਸ ਉਸਦੇ ਸੈਕੰਡਰੀ ਸਕੂਲ ਨਹੀਂ ਖੋਲਿਆ ਜਾ ਸਕਦਾ ਤਾਂ ਪਿੰਡ ਦੇ ਬੱਚਿਆਂ ਨੂੰ ਜਿਹੜੀ ਟ੍ਰਾਂਸਪੋਰਟ ਦੀ ਸਹੂਲਤ ਦੇ ਦਿੱਤੀ ਜਾਣੀ ਚਾਹੀਦੀ ਹੈਗੀ ਦੂਸਰਾ ਕੀ ਆ ਜਿਹੜੀ ਬੱਚਿਆਂ ਨੂੰ ਸਕੋਲਰਸ਼ਿਪ ਦਿੱਤੀ ਜਾਂਦੀ ਹੈ ਉਹ ਕਾਫ਼ੀ ਟਾਈਮ ਬਾਅਦ ਮਿਲਦੀ ਆ ਅਤੇ ਉਹ ਨਿਯਮਤ ਸਮੇਂ ਦੇ ਵਿੱਚ ਹੀ ਦੇਣੀ ਚਾਹੀਦੀ ਹੈਗੀ ਅਤੇ ਉਹਦੇ ਵਿੱਚ ਮਿਲਣ ਵਾਲੀ ਰਾਸ਼ੀ ਦੀ ਮਾਤਰਾ ਵੀ ਉਹਨਾਂ ਦੇ ਖਰਚਿਆਂ ਦੇ ਮੁਤਾਬਿਕ ਘੱਟ ਹੈਗੀ ਉਹ ਰਾਸ਼ੀ ਨੂੰ ਵਧਾ ਦਿੱਤਾ ਜਾਣਾ ਚਾਹੀਦਾ ਗਾ